ਹਾਂਜੀ ਅਸ਼ੋਕ ਢਾਬੇ ਤੋਂ ਬੋਲਦੇ ਮੈਂ ਪਰਮਜੀਤ ਸਿੰਘ ਬੋਲਦਾ ਤੁਹਾਨੂੰ ਆਰਡਰ ਕੀਤਾ ਸੀਗਾ ਖਾਣੇ ਦਾ ਤੁਹਾਨੂੰ ਕਿਹਾ ਸੀ ਚਿਕਨ ਭੇਜਿਓ ਅਤੇ ਤੁਸੀਂ ਵੈਸ਼ਨੂੰ ਖਾਣਾ ਭੇਜ ਕੇ ਅਤੇ ਮੇਰੇ ਘਰ ਪਾਲਟੀ ਰੱਖੀ ਸੀ ਨਾਲੇ ਬੇਇੱਜ਼ਤੀ ਕਰਾ ਦਿੱਤੀ ਮੇਰੀ ਕਿਉਂਕਿ ਐਨੀ ਸ਼ਰਮਿੰਦਗੀ ਆਈ ਮੈਨੂੰ ਕੋਈ ਹਿਸਾਬ ਨਹੀਂ ਇਸ ਤੋਂ ਅਗਾਂਹ ਮੈਂ ਤੁਹਾਨੂੰ ਆਰਡਰ ਕੋਈ ਨਹੀਂ ਕਰੂੰਗਾ ਕਿਉਂ ਉਹ ਨਾਲ ਯਾਰਾਂ ਦੋਸਤਾਂ ਨੂੰ ਕਹਾਂਗਾ ਕਿ ਇਹ ਢਾਬੇ 'ਤੇ ਕੋਈ ਆਰਡਰ ਨਾ ਕਰਿਓ